ਛੁੱਟੀ ਵਾਲੇ ਦਿਨ ਅਸੀਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੁੰਦੇ ਹਨ ਅਤੇ ਸਭ ਦੀ ਮਨਪਸੰਦ ਦਾ ਭੋਜਨ ਬਣਾਉਂਦੇ ਹਨ ਅਤੇ ਰਲ਼ ਕੇ ਬੈਠ ਕੇ ਉਸ ਭੋਜਨ ਦਾ ਆਨੰਦ ਮਾਣਦੇ ਹਨ ਅਤੇ ਆਪਣੇ ਮਿਲ ਕੇ ਆਪਣੇ ਹਫਤੇ ਦੇ ਕੰਮਕਾਰਾਂ ਦੀ ਜਾਣਕਾਰੀ ਇੱਕ ਦੂਜੇ ਨੂੰ ਦਿੰਦੇ ਹਨ ਕਿਉਂਕਿ ਇਕ ਛੁੱਟੀ ਵਾਲ਼ਾ ਹੀ ਦਿਨ ਹੁੰਦਾ ਹੈ ਜਦੋਂ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੁੰਦੇ ਹਨ ਨਹੀਂ ਸਭ ਦੇ ਆਪਣੇ ਆਪਣੇ ਕੰਮ ਹੁੰਦੇ ਹਨ ਅਤੇ ਸਭ ਆਪਣੀ ਆਪਣੀ ਡਿਊਟੀਆਂ 'ਤੇ ਚਲੇ ਜਾਂਦੇ ਹਨ ਸ਼ਾਮ ਵੇਲ਼ੇ ਇਕੱਠੇ ਹੁੰਦੇ ਹਨ